ਪੰਜਾਬ ਦੇ ਪੇਂਡੂ ਲੋਕਾਂ ਲਈ ਖੇਡਾਂ ਦਾ ਬੜਾ ਮਹੱਤਵ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਲੋਕ ਆ ਜ਼ਿਆਦਾਤਰ ਆਪਣੀ ਸਰੀਰਕ ਵਰਜਿਸ਼ ਲਈ ਆਪਣੀ ਮਾਨਸਿਕ ਸੰ ਸੰਤੁਸ਼ਟੀ ਲਈ ਖੇਡਾਂ ਦਾ ਸਹਾਰਾ ਲੈਂਦੇ ਹਨ ਪਰ ਇਹ ਜਿਹੜੀਆਂ ਖੇਡਾਂ ਹੈਗੀਆਂ ਇਹ ਖੇਤਾਂ ਦੇ ਵਿੱਚ ਖੇਡੀਆਂ ਜਾਂਦੀਆਂ ਮਿੱਟੀ 'ਤੇ ਖੇਡੀਆਂ ਜਾਂਦੀਆਂ ਉਹਨਾਂ ਨੂੰ ਮਿੱਟੀ 'ਤੇ ਖੇਡਾਂ ਖੇਡਣ ਨਾਲ ਕੁਛ ਸ ਜਿਹੜੇ ਮਿੱਟੀ ਦੇ ਤੱਤ ਵੀ ਮਿਲਦੇ ਆ ਉਹਨਾਂ ਨੂੰ ਮਿੱਟੀ ਦੇ ਨਾਲ ਮੋਹ ਵੀ ਹੁੰਦਾ ਅਸੀਂ ਆਮ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਉਹ ਡਾਕਟਰਾਂ ਨੂੰ ਬਹੁਤ ਘੱਟ ਪੈਸੇ ਦਿੰਦੇ ਹਨ ਇਸ ਦਾ ਮੁੱਖ ਕਾਰਨ ਆ ਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਉਹਨਾਂ ਰਾਹੀਂ ਉਹਨਾਂ ਦੀ ਸਰੀਰਕ ਤੰਦਰੁਸਤੀ ਬਣੀ ਰਹਿੰਦੀ ਹੈ ਜੋਰ ਲੱਗਿਆ ਰਹਿੰਦਾ ਹੈ ਪਸੀਨਾ ਆਉਂਦਾ ਰਹਿੰਦਾ ਜਿਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਆਪਣੇ ਆਪ ਰਫੂ ਚੱਕਰ ਹੋ ਜਾਂਦੀਆਂ ਅਤੇ ਉਹਨਾਂ ਨੂੰ ਡਾਕਟਰਾਂ ਦੀ ਸਹਾਇਤਾ ਬਹੁਤ ਘੱਟ ਲੈਣੀ ਪੈਂਦੀ ਹੈ ਤੁਸੀਂ ਦੇਖੋਗੇ ਕਿ ਸ਼ਹਿਰਾਂ ਦੇ ਮੁਕਾਬਲਤਨ ਪਿੰਡਾਂ ਦੇ ਲੋਕ ਵੱਧ ਉਮਰ ਭੋਗਦੇ ਹਨ ਵੱਧ ਤੰਦਰੁਸਤ ਰਹਿੰਦੇ ਹਨ ਵੱਧ ਤਕੜੇ ਹਨ ਇਸ ਦਾ ਮੁੱਖ ਕਾਰਨ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਮਿੱਟੀ ਦੇ ਵਿੱਚ ਖੇਡੀਆਂ ਜਾਂਦੀਆਂ ਉਹ ਖੇਡਾਂ ਉਹਨਾਂ ਦਾ ਜੋਰ ਅਜਮਾਇਸ਼ ਕਰਵਾਉਂਦੀਆਂ ਜਿਵੇਂ ਕਬੱਡੀ ਕੁਸ਼ਤੀ ਇਹ ਆਪਣੇ ਆਪ ਦੇ ਵਿੱਚ ਹੀ ਬੜੀਆਂ ਜੋਰ ਅਜਮਾਇਸ਼ ਨਾਲ ਖੇਡੀਆਂ ਜਾਣ ਵਾਲੀਆਂ ਖੇਡਾਂ ਜੋ ਬਿਨਾਂ ਵੀ ਜਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਉਹਨਾਂ ਦੇ ਵਿੱਚ ਚੁਸਤੀ ਫੁਰਤੀ ਦਾ ਬੜਾ ਮਹੱਤਵ ਆ ਇਸ ਦੇ ਲਈ ਪਿੰਡਾਂ ਦੇ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਪੱਖੋਂ ਤੰਦਰੁਸਤ ਰੱਖਦੀਆਂ ਹਨ